ਪਿੰਡਾਂ ਵਿੱਚ ਬਿਜਲੀ ਸੋਲਰ ਸਿਸਟਮ ਪੌਣ ਚੱਕੀਆਂ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਖੇਤੀ 'ਤੇ ਨਿਰਭਰ ਹੋਣ ਵਾਲੀਆਂ ਚੀਜ਼ਾਂ ਜਿਵੇਂ ਆਪਾਂ ਜਿਹੜਾ ਫਸਲਾਂ ਨੂੰ ਪਾਣੀ ਦਿੰਦੇ ਹਾਂ ਉਹ ਬਿਜਲੀ ਅਧਾਰਿਤ ਪੰਪ ਸੈਟ ਕਰ ਸਕਦੇ ਹਾਂ ਜਿਹੜੇ ਪੈਟਰੋਲ ਅਧਾਰਿਤ ਪੰਪ ਸੈਟ ਹੁੰਦੇ ਨੇ ਉਹਨਾਂ ਦੇ ਵਿੱਚ ਦਸ ਪ੍ਰਤੀਸ਼ਤ ਜ਼ਿਆਦਾ ਖਰਚ ਹੁੰਦਾ ਹੈ ਜਦਕਿ ਜਿਹੜੇ ਬਿਜਲੀ ਅਧਾਰਿਤ ਪੰਪ ਸੈਟ ਹੁੰਦੇ ਨੇ ਉਨ੍ਹਾਂ ਵਿੱਚ ਜਿਹੜਾ ਖਰਚਾ ਹੈ ਉਨ੍ਹਾਂ ਨਾਲੋ ਘੱਟ ਆਉਂਦਾ ਹੈ